ਸ਼ੁਰੂਆਤੀ ਦਿਨਾਂ ਦੇ ਵਿੱਚ ਮੇਰੇ ਕੋਲ ਟਰੈਕਿੰਗ ਦਾ ਇੰਨਾਂ ਸਮਾਨ ਹੀ ਨਹੀਂ ਸੀ ਹੁੰਦਾ ਕਿਉਂਕਿ ਮੈਨੂੰ ਉਸ ਬਾਰੇ ਕੁਝ ਪਤਾ ਹੀ ਨਹੀਂ ਸੀ ਜਦੋਂ ਮੇਰੇ ਅਧਿਆਪਕਾਂ ਨੇ ਮੈਨੂੰ ਦੱਸਿਆ ਵੀ ਟਰੈਕਿੰਗ 'ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ ਤਾਂ ਮੈਂ ਉਹ ਸਮਾਨ ਖਰੀਦਿਆ ਅਤੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਬੂਟ ਵਧੀਆ ਕੁਆਲਿਟੀ ਦੇ ਬੂਟ ਹੋਣੇ ਚਾਹੀਦੇ ਹਨ ਤਾਂ ਕਿ ਜਦੋਂ ਅਸੀਂ ਪਹਾੜਾਂ 'ਤੇ ਚੜ੍ਹੀਏ ਸਾਨੂੰ ਕੋਈ ਦਿੱਕਤ ਨਾ ਆਵੇ ਸਾਨੂੰ ਪਰੇਸ਼ਾਨੀ ਨਾ ਹੋਵੇ ਸਾਡਾ ਪੈਰ ਨਾ ਮੁੜੇ ਇਹਨਾਂ ਚੀਜ਼ਾਂ ਦਾ ਧਿਆਨ ਖਾਸ ਧਿਆਨ ਰੱਖਣਾ ਹੈ ਅਤੇ ਸਾਡੇ ਕੋਲ ਇੱਕ ਟਰੈਕਸੂਟ ਹੋਣਾ ਚਾਹੀਦਾ ਜ਼ਰੂਰੀ ਇਹ ਤਾਂ ਜ਼ਰੂਰੀ ਹੀ ਹੋਣਾ ਚਾਹੀਦਾ ਇੱਕ ਤਾਂ ਹੋਣਾ ਹੀ ਚਾਹੀਦਾ ਜੇ ਦੋ ਨਹੀਂ ਤਾਂ ਟੋਰਚ ਇਹ ਵੀ ਬਹੁਤ ਲਾਭਦਾਇਕ ਹੈ ਅਤੇ ਚਸ਼ਮੇ ਇਹ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਪਹਾੜਾਂ ਦੇ ਵਿੱਚ ਇਹਨਾਂ ਦੀ ਅਕਸਰ ਜ਼ਰੂਰਤ ਪੈਂਦੀ ਹੀ ਰਹਿੰਦੀ ਆ ਅਤੇ ਰੇਨਕੋਟ ਕਿਉਂਕਿ ਜਦੋਂ ਅਸੀਂ ਪਹਾੜਾਂ 'ਚ ਜਾਂਦੇ ਆ ਪਹਾੜਾਂ ਦੇ ਮੌਸਮ ਦਾ ਕੋਈ ਵੀ ਪਤਾ ਨਹੀਂ ਹੁੰਦਾ ਕਦੋਂ ਮੀਂਹ ਆ ਜੇ ਕਦੋਂ ਧੁੱਪ ਨਿਕਲ ਆਵੇ ਕਦੋਂ ਕੀ ਹੋਵੇ ਕੁਛ ਵੀ ਨਹੀਂ ਪਤਾ ਸਾਨੂੰ ਜੋ ਵੀ ਆ ਉੱਥੇ ਐਟ ਏ ਟਾਈਮ 'ਤੇ ਵੈਦਰ ਚੇਂਜ ਹੋ ਹੀ ਜਾਂਦਾ ਕਿਸੇ ਵੀ ਤਰੀਕੇ ਨਾਲ ਇਹ ਸਮਾਨ ਮੈਂ ਆਪਣੇ ਹੀ ਬਾਜ਼ਾਰ ਦੇ ਲੋਕ ਲੋਕਲ ਜਿਹੜਾ ਸ਼ੋਪ ਸੀ ਦੁਕਾਨ ਮੈਂ ਉੱਥੋਂ ਖਰੀਦਿਆ ਠੀਕ ਠਾਕ ਪੈ ਗਿਆ ਹੌਲੀ ਹੌਲੀ ਕਰਕੇ ਮੇਰੇ ਕੋਲ ਹੋਰ ਸਮਾਨ ਵੱਧ ਗਿਆ ਅਤੇ ਅਕਸਰ ਜੇ ਵੇਖਿਆ ਜਾਵੇ ਵੀ ਟਰੈਕਿੰਗ ਲਈ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਹੈ ਅਤੇ ਮੈਨੂੰ ਲੱਗਦਾ ਵੀ ਇਹਨਾਂ ਦੀ ਸਭ ਤੋਂ ਪਹਿਲਾਂ ਵਧੀਆ ਵਧੀਆ ਤੋਂ ਵਧੀਆ ਬੂਟ ਹੋਣੇ ਚਾਹੀਦੇ ਆ ਟ ਟਰੈਕਸੂਟ ਹੋਣਾ ਚਾਹੀਦਾ ਗਲਵਸ ਹੋਣੇ ਚਾਹੀਦੇ ਆ ਟਾਰਚ ਹੋਣੀ ਚਾਹੀਦੀ ਹੈ ਚਸ਼ਮੇ ਹੋਣੇ ਚਾਹੀਦੇ ਆ ਕੋਲ ਅਤੇ ਇੱਕ ਨਾਲ ਡੰਡਾ ਵੀ ਹੋਣਾ ਚਾਹੀਦਾ ਜਦੋਂ ਅਸੀਂ ਟਰੈਕਿੰਗ 'ਤੇ ਜਾਦੇ ਆ ਤਾਂ ਫਿਰ ਉਹ ਉੱਤੇ ਦੀ ਉੱਤੇ ਪਹਾੜ ਜਾਂਦੇ ਆ ਨਾ ਜਦੋਂ ਉਦੋਂ ਸਾਨੂੰ ਚੜ੍ਹਨ ਵਿੱਚ ਔਖਾ ਹੁੰਦਾ ਅਤੇ ਨਾਲ ਸਾਡੇ ਕੋਲ ਇੱਕ ਡੰਡਾ ਤਾਂ ਹੋਣਾ ਚਾਹੀਦਾ ਹੈ ਜੇ ਅਸੀਂ ਉੱਥੇ ਕਿਤੇ ਰਾਤ ਰੁਕਣਾ ਤਾਂ ਉੱਥੇ ਰਾਤ ਅਸੀਂ ਹੋਟਲਾਂ 'ਚ ਵੀ ਰੁਕ ਸਕਦੇ ਹਾਂ ਲੇਕਿਨ ਕਈ ਵਾਰ ਕੈਂਪਿੰਗ ਵੀ ਕਰਨੀ ਹੁੰਦੀ ਬੰਦੇ ਨੇ ਕੈਂਪਿੰਗ ਲਈ ਉੱਥੇ ਜਿਹੜਾ ਵੀ ਲੋੜ ਮੁਤਾਬਿਕ ਸਮਾਨ ਹੋਵੇ ਉਹ ਵੀ ਚਾਹੀਦਾ ਉਹਦੀ ਵੀ ਬਹੁਤ ਲੋੜ ਹੁੰਦੀ ਆ ਪਹਾੜਾਂ 'ਚ ਕੋਈ ਪਤਾ ਨਹੀਂ ਕਦੋਂ ਕੀ ਹੋ ਜੇ ਕਿਹੜੀ ਸਿਚੁਏਸ਼ਨ ਆ ਜੇ ਉਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ